ਪਹਿਲਾਂ ਅਤੇ ਹੁਣ ਦੇ ਸਮੇਂ ਦੀਆਂ ਖੇਡਾਂ ਜਾਂ ਗੇਮਿੰਗ ਇੰਡਸਟਰੀ ਵਿੱਚ ਕਾਫੀ ਬਦਲਾਵ ਆਏ ਹਨ ਪਹਿਲਾਂ ਖੇਡਾਂ ਵਿੱਚ ਇੰਨਾ ਇੰਟਰਸਟ ਨਹੀਂ ਦੇਖਿਆ ਜਾ ਸਕਦਾ ਸੀ ਹੁਣ ਉਹ ਜਿਵੇਂ ਜਿਵੇਂ ਸਮਾਂ ਬਦਲ ਰਿਹਾ ਹੈ ਇਹ ਖੇਡਾਂ ਦੀ ਇੰਡਰਸਟਰੀ ਜਾਂ ਗੇਮਿੰਗ ਇੰਡਸਟਰੀ ਵਿੱਚ ਵੀ ਬਦਲਾਵ ਆ ਰਹੇ ਹਨ ਖੇਡਾਂ ਹੋਰ ਐਡਵਾਂਸ ਹੋ ਰਹੀਆਂ ਹਨ ਅਤੇ ਅੱਗੇ ਵੱਲ ਵਧ ਰਹੀਆਂ ਹਨ ਨਾਲ ਇਹ ਸਭ ਚੀਜ਼ਾਂ ਵਧਣ ਦੇ ਨਾਲ ਨਾਲ ਖਿਡਾਰੀਆਂ ਵਿੱਚ ਮੁਕਾਬਲੇ ਦਾ ਦੌਰ ਅਤੇ ਜਾਂ ਫਿਰ ਕੰਪਟੀਸ਼ਨ ਵੀ ਬਹੁਤ ਹੱਦ ਤੱਕ ਵੱਧ ਚੁੱਕਿਆ ਹੈ ਜਿਸ ਕਰਕੇ ਜੇ ਆਪਾਂ ਦੇਖ ਗੌਰ ਕਰੀਏ ਤਾਂ ਗੇਮਿੰਗ ਅਤੇ ਗੇਮਿੰਗ ਇੰਡਸਟਰੀ ਵਿੱਚ ਕਾਫੀ ਕੁਝ ਬਦਲ ਰਿਹਾ ਹੈ ਜਦੋਂ ਮੈਂ ਇੰਡਸਟਰੀ ਜੁਆਇਨ ਕੀਤੀ ਸੀ ਉਦੋਂ ਜਿਹੜਾ ਕੰਪਟੀਸ਼ਨ ਲੈਵਲ ਸੀ ਉਹ ਇੰਨਾ ਹਾਈ ਨਹੀਂ ਸੀ ਹੁਣ ਜੇ ਦੇਖਿਆ ਜਾਏ ਤਾਂ ਗੇਮਿੰਗ ਇੰਡਸਟਰੀ ਵਿੱਚ ਖੇਡਾਂ ਅਤੇ ਖਿਡਾਰੀਆਂ ਵਿੱਚ ਬਹੁਤ ਫਰਕ ਆਏ ਹਨ ਖਿਡਾਰੀਆਂ ਵਿੱਚੋਂ ਵੱਧ ਜੋਸ਼ ਦੇਖਿਆ ਜਾ ਸਕਦਾ ਹੈ ਪਰ ਹਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਪਹਿਲਾਂ ਕਾਫੀ ਲੋਕ ਖੇਡਾਂ ਖੇਡਾਂ ਨਾਲ ਜੁੜੇ ਸੀ ਹੁਣ ਅੱਜ ਕੱਲ੍ਹ ਦੀ ਜੋ ਪੀੜ੍ਹੀ ਹੈ ਜੋ ਸਾਡੇ ਦੇਸ਼ ਦਾ ਕੱਲ੍ਹ ਹੈ ਉਹ ਖੇਡਾਂ ਵੱਲ ਘੱਟ ਰੁਝਾਅ ਦਿਖਾ ਰਹੀ ਹੈ ਇਹ ਵੀ ਕਿਹਾ ਜਾ ਸਕਦਾ ਕਿ ਕੁਝ ਦਿਖਾ ਵੀ ਰਹੇ ਨੇ ਪਰ ਕਾਫੀ ਹੱਦ ਤੱਕ ਜੋ ਪੀੜ੍ਹੀ ਹੈ ਉਹ ਹੋਰ ਕੰਮਾਂ ਕਾਰਾਂ ਵਿੱਚ ਜਿਵੇਂ ਮੋਬਾਈਲ ਅਤੇ ਹੋਰ ਚੀਜ਼ਾਂ ਵਿੱਚ ਉਲਝੇ ਨੇ ਅਤੇ ਖੇਡਾਂ ਵਿੱਚ ਘੱਟ ਆਪਣਾ ਰੁਝਾਅ ਦਿਖਾ ਰਹੇ ਹਨ